ਜੀ ਹਾਂ ਮੈਂ ਸੋਚਦਾ ਹਾਂ ਕਿ ਲੋਕਾਂ ਨੂੰ ਥੋੜ੍ਹੀ ਬਹੁਤੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਆਪਣੇ ਰਾਜ ਅਤੇ ਉਸਦੇ ਭੂਗੋਲ ਬਾਰੇ ਜੇ ਮੈਂ ਆਪਣੇ ਰਾਜ ਦੀ ਬਾਰੇ ਗੱਲ ਕਰਾਂ ਤਾਂ ਸਾਡੇ ਰਾਜ ਬਾਰੇ ਲੋਕਾਂ ਨੂੰ ਬਹੁਤ ਚੀਜ਼ਾਂ ਪਤਾ ਹੋਣੀਆਂ ਚਾਹੀਦੀ ਜਿਵੇਂ ਕਿ ਸਾਡੇ ਰਾਜ ਦਾ ਇਤਿਹਾਸ ਇਹਦਾ ਪਿਛੋਕੜ ਸਾਡੇ ਇੱਥੋਂ ਦੇ ਮੰਤਰੀਆਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਇੱਥੋਂ ਦੇ ਕਿੱਤੇ ਇੱਥੋਂ ਦੇ ਕਾਰਜ ਇੱਥੇ ਜਿਹੜੀਆਂ ਫੈਕਟਰੀਆਂ ਬਣ ਰਹੀਆਂ ਨੇ ਇੱਥੋਂ ਦਾ ਭੂਗੋਲਿਕ ਸਾਨੂੰ ਹਰ ਇੱਕ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਹਰ ਇੱਕ ਚੀਜ਼ ਦੀ ਜਾਣਕਾਰੀ ਹੋਣ ਨਾਲ ਅਸੀਂ ਆਪਣੇ ਰਾਜ ਦੇ ਨਾਲ ਜੁੜ ਸਕਦੇ ਹਾਂ ਧੰਨਵਾਦ